ਸਰ ਮੈਂ ਆਪਣਾ ਵਿਹਲਾ ਸਮਾਂ ਪਹਿਲਾਂ ਸਵੇਰੇ ਉੱਠਦੇ ਸਾਰ ਹੀ ਇਸ਼ਨਾਨ ਪਾਣੀ ਕਰਕੇ ਗੁਰੂ ਘਰ ਜਾਂਦੇ ਹਾਂ ਜੀ ਗੁਰੂ ਘਰ ਤੋਂ ਬਾਅਦ ਫੇਰ ਮੱਝਾਂ ਰੱਖੀਆਂ ਮੱਝਾਂ ਦਾ ਕੰਮ ਕਰਦੇ ਹਾਂ ਜੀ ਉਹ ਤੋਂ ਬਾਅਦ 'ਚੋਂ ਜੀ ਸਵੇਰੇ ਸਾਢੇ ਅੱਠ ਨੌ ਵਜੇ ਕਾਲਜ ਆ ਜਾਂਦੇ ਹਾਂ ਜੀ ਕਾਲਜ ਆ ਕੇ ਫਿਰ ਮੈਂ ਫੁੱਲਾਂ ਦਾ ਕੰਮ ਕਰਦਾ ਜੀ ਮਾਲੀ ਦਾ ਜੀ ਉੱਥੇ ਕਿਆਰੀਆਂ ਦੀ ਦੇਖਭਾਲ ਕਰਦੇ ਹਾਂ ਜੀ ਪਾਣੀ ਲਾਉਣਾ ਬੂਟਿਆਂ ਨੂੰ ਜਦੋਂ ਹੋਰ ਥੋੜ੍ਹਾ ਜਿਹਾ ਸਮਾਂ ਵਿਹਲਾ ਹੁੰਦਾ ਤਾਂ ਪਰਮਾਤਮਾ ਦੀ ਥੋੜ੍ਹੀ ਬੰਦਗੀ ਕਰ ਲਈ ਦੀ ਆ ਜੀ ਮਹਾਰਾਜ ਦਾ ਨਾਂ ਜਪ ਲਈ ਦਾ ਜੀ ਪਰਮਾਤਮਾ ਦਾ ਨਾਂ ਜਪਣ ਤੋਂ ਬਾਅਦ ਜਦੋਂ ਵੀ ਹੋਰ ਵਿਹਲੇ ਹੁੰਦੇ ਹਾਂ ਤਾਂ ਕਿਆਰੀਆਂ 'ਚ ਰੇਹ ਪਾ ਲੈਂਦੇ ਹਾਂ ਜੀ ਉਹਨਾਂ ਦੀ ਗੁੱਡ ਗੁਡਾਈ ਜੀ ਘਾਹ ਫੂਸ ਜੋ ਵੀ ਕਿਆਰੀਆਂ 'ਚੋਂ ਕੱਢਣਾ ਉਹ ਕੱਢ ਦਿੰਦੇ ਹਾਂ ਜੀ ਉਹ ਤੋਂ ਬਾਅਦ 'ਚੋਂ ਫੇਰ ਉਹ ਕੱਢਣ ਤੋਂ ਬਾਅਦ ਅਤੇ ਚੁੱਕ ਦਈਦਾ ਉਹਨੂੰ ਘਾਹ ਫੂਸ ਨੂੰ ਬਾਹਰ ਚੁੱਕਣ ਤੋਂ ਬਾਅਦ ਫੇਰ ਝਾੜੂ ਮਾਰ ਦਈਦਾ ਪਾਰਕ ਦੇ ਵਿੱਚ ਝਾੜੂ ਮਾਰਨ ਤੋਂ ਬਾਅਦ ਜੀ ਫੇਰ ਘੜੀ ਪਰਮਾਤਮਾ ਦਾ ਫੇਰ ਨਾਂ ਲਈ ਦਾ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਪਰਮਾਤਮਾ ਸੱਚੇ ਪਾਤਸ਼ਾਹ ਸਭ ਦਾ ਭਲਾ ਕਰੇ ਸੁੱਖ ਸ਼ਾਂਤ ਨਾਲ ਦਿਹਾੜੀ ਬਤੀਤ ਹੋਈ ਹੈ ਮਹਾਰਾਜ ਤੇਰਾ ਬਹੁਤ ਸ਼ੁਕਰਾਨਾ ਉਹ ਤੋਂ ਬਾਅਦ 'ਚੋਂ ਜੀ ਛੁੱਟੀ ਦਾ ਟੈਮ ਹੋ ਜਾਂਦਾ ਜੀ ਛੁੱਟੀ ਦੇ ਟੈਮ ਤੋਂ ਬਾਅਦ ਘਰ ਜਾ ਕੇ ਚਾਹ ਪਾਣੀ ਪੀ ਕੇ ਫੇਰ ਪੱਠੇ ਕੁਤਰਨ ਜਾਈਦੇ ਹੈ ਜੀ ਸ਼ਾਮ ਨੂੰ ਡਿਊਟੀ ਤੋਂ ਬਾਅਦ ਪੱਠੇ ਕੁਤਰਨ ਤੋਂ ਬਾਅਦ ਫੇਰ ਆ ਕੇ ਟੋਕਾ ਟੁੱਕੀ ਦਾ ਹੈ ਟੋਕਾ ਟੁੱਕਣ ਤੋਂ ਬਾਅਦ ਮੱਝਾਂ ਨੂੰ ਕੱਖ ਪਾਈਦੇ ਹੈ ਇੰਨੇ ਨੂੰ ਰੋਟੀ ਪਾਣੀ ਖਾ ਕੇ ਫੇਰ ਆਪਣੇ ਭਾਈ ਬੈਡ 'ਤੇ ਸੌ ਜਾਂਦੇ ਹਾਂ ਚਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ